ਮੈਨੂੰ ਹਾਲੇ ਤੱਕ ਤਾਂ ਕੋਈ ਸਾਜ਼ ਵਜਾਉਣਾ ਨਹੀਂ ਆਉਂਦਾ ਪਰ ਮੈਂ ਗਿਟਾਰ ਸਿੱਖਣਾ ਚਾਹੁੰਦਾ ਹਾਂ ਕਿਉਂਕਿ ਗਿਟਾਰ ਸਿੱਖਣਾ ਮੈਨੂੰ ਸੌਖਾ ਅਤੇ ਮੇਰਾ ਸੌਕ ਹੈ ਗਿਟਾਰ ਵਜਾਉਣਾ ਅਜੇ ਮੈਂ ਗਿਟਾਰ ਸਿੱਖਦਾ ਹਾਂ ਗਿਟਾਰ ਸਿੱਖਣ ਦੇ ਮੈਨੂੰ ਦੋ ਕਾਰਨ ਹਨ ਪਹਿਲਾ ਸੰਗੀਤ ਦੇ ਰੂਪ ਵਿੱਚ ਗਿਟਾਰ ਸੀ ਖੇਡਾਂ ਮਨੋਰੰਜਨ ਅਤੇ ਆਨੰਦ ਦਾ ਸਰੋਤ ਬਣ ਸਕਦਾ ਹੈ ਦੂਜਾ ਇਹ ਤੁਹਾਨੂੰ ਇੱਕ ਕਲਾ ਅਤੇ ਸ਼ਬਦਾਂ ਦੇ ਜਹਾਨ ਵਿੱਚ ਡੁੱਬ ਕੇ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਮੌਕਾ ਦਿੱਤਾ ਦਿੰਦਾ ਹੈ ਗਿਟਾਰ ਸਿੱਖਣ ਲਈ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਹਨ ਜਿਵੇਂ ਕਿ ਪਹਿਲਾਂ ਗਿਟਾਰ ਖਰੀਦਣਾ ਪੈਂਦਾ ਹੈ ਉਸ ਤੋਂ ਬਾਅਦ ਇਸ ਨੂੰ ਸਿੱਖਣ ਵਾਲੇ ਕੋਰਸ ਜਾਂ ਕਿਸੇ ਟਿਊਟਰ ਨਾਲ ਜੁੜਨਾ ਪੈਂਦਾ ਹੈ ਇਸ ਤੋਂ ਇਲਾਵਾ ਗਿਟਾਰ ਸਿੱਖਣ ਦੀਆਂ ਨਵੀਆਂ ਨਵੀਆਂ ਤਕਨੀਕਾਂ ਜਿਵੇਂ ਸਿੰਗਰ ਪੀਕਿੰਗ ਅਤੇ ਕੋਡਾਂ ਨੂੰ ਸਿੱਖਣਾ ਜ਼ਰੂਰੀ ਹੁੰਦਾ ਹੈ ਇਸ ਇਹ ਬੰਦਾ ਕਿਸੇ ਵੀ ਮਾਹਿਰ ਗਿਟਾਰ ਵਜਾਉਣ ਵਾਲੇ ਤੋਂ ਇਲਾਵਾ ਨਹੀਂ ਸਿੱਖ ਸਕਦਾ ਇਸਨੂੰ ਸਿੱਖਣ ਲਈ ਕਿਸੇ ਵੀ ਕੋਰਸ ਜਾਂ ਟਿਊਟਰ ਦੀ ਲੋੜ ਪੈਂਦੀ ਹੈ ਗਿਟਾਰ ਦੀਆਂ ਬਹੁਤ ਸਾਰੀਆਂ ਧੁਨੀਆਂ ਲੋਕਾਂ ਨੂੰ ਅਟਰੈਕਟ ਵੀ ਕਰਦੀਆਂ ਹਨ ਅਤੇ ਇੱਕ ਚੰਗਾ ਮਨੋਰੰਜਨ ਦਾ ਸਾਧਨ ਹੈ ਗਿਟਾਰ ਮੈਂ ਆਪਣੇ ਵਿਹਲੇ ਸਮੇਂ ਵਿੱਚ ਸਿੱਖਦਾ ਹਾਂ ਇਹ ਮੈਨੂੰ ਸੌਖਾ ਵੀ ਲੱਗਦਾ ਹੈ ਕਿਉਂਕਿ ਮੈਂ ਛੇਤੀ ਹੀ ਬਹੁਤ ਸਾਰੀਆਂ ਧੁਨੀਆਂ ਵਜਾਉਣੀਆਂ ਸਿੱਖ ਜਾਂਦਾ ਹਾਂ